ਮੇਰੀ ਹੁਣ ਤੱਕ ਦੀ ਜ਼ਿੰਦਗੀ ਵਿੱਚ ਹੁਣ ਤੱਕ ਇਦਾਂ ਦੀ ਕੋਈ ਚੁਣੌਤੀ ਨਹੀਂ ਆਈ ਜਿਸਦਾ ਕਿ ਮੈਨੂੰ ਸਾਹਮਣਾ ਕਰਨਾ ਪਿਆ ਪਰ ਅਗ ਜੇਕਰ ਅੱਗੇ ਤੋਂ ਮੈਨੂੰ ਇਦਾਂ ਦੀ ਕੋਈ ਵੀ ਵੱਡੀ ਚੁਣੌਤੀ ਆਈ ਤਾਂ ਮੈਂ ਉਸਦਾ ਡੱਟ ਕੇ ਸਾਹਮਣਾ ਕਰਾਂਗੀ